ਹਾਂਜੀ ਜਦੋਂ ਮੈਂ ਛੇਵੀਂ ਕਲਾਸ 'ਚ ਸੀਗੀ ਮੈਂ ਉਦੋਂ ਦਾ ਯੋਗਾ ਕਰਨਾ ਸ਼ੁਰੂ ਕੀਤਾ ਸੀ ਹਾਂ ਵਿੱਚ ਦੀ ਮੇਰਾ ਵੀ ਯੋਗਾ ਛੁੱਟ ਗਿਆ ਹੈ ਹੁਣ ਮੈਂ ਕਾਲਜ ਜਾਂ ਤਾਂ ਮੈਂ ਸੋਚਦੀ ਹਾਂ ਕਿ ਹਰ ਰੋਜ਼ ਸੁਬਹਾ ਉੱਠ ਕੇ ਯੋਗਾ ਕਰਾਂ ਪਰ ਗੱਲ ਇਹ ਆ ਕਿ ਰਾਤ ਨੂੰ ਸੌਣਾ ਹੁੰਦਾ ਦੇਰ ਤੱਕ ਪੜ੍ਹਨਾ ਹੁੰਦਾ ਦੋ ਦੋ ਵਜੇ ਸੋਣੇ ਆ ਕੰਮ ਹੀ ਐਨੇ ਹੁੰਦੇ ਆ ਅਤੇ ਸੁਬਹਾ ਸਾਢੇ ਅੱਠ ਤੋਂ ਕਲਾਸਾਂ ਹੁੰਦੀਆਂ ਤਾਂ ਕਰਨ ਦਾ ਯੋਗਾ ਟਾਈਮ ਹੀ ਨਹੀਂ ਮਿਲਦਾ ਕੋਸ਼ਿਸ਼ ਬਹੁਤ ਕਰਦੇ ਹਾਂ ਕਿ ਕਰੀਏ ਮੈਂ ਕਰਦੀ ਹੁੰਦੀ ਸੀ ਯੋਗਾ ਬਹੁਤ ਸਾਰੇ ਆਸਨ ਪ ਪਰ ਜਦੋਂ ਵਿੱਚ ਦੀ ਟਾਈਮ ਮਿਲਦਾ ਹੈਗਾ ਤਾਂ ਕਰ ਵੀ ਲਈਦਾ ਹੈਗਾ ਵਿੱਚ ਦੀ ਸ਼ੁਰੂ ਕੀਤਾ ਸੀ ਪਰ ਫਿਰ ਉਹੀ ਸ਼ਡਿਊਲ ਕਰਕੇ ਥੋੜ੍ਹਾ ਵਿਗੜ ਗਿਆ ਕੰਮ